ਸਾਡੇ ਇਲਾਕੇ ਵਿੱਚ ਸਾਰੇ ਹੀ ਧਰਮਾਂ ਦੇ ਲੋਕ ਪਾਏ ਜਾਂਦੇ ਨੇ ਅਤੇ ਸਾਰਿਆਂ ਨੂੰ ਹੀ ਆਪੋ ਆਪਣੇ ਧਰਮ ਪਿਆਰੇ ਹੁੰਦੇ ਨੇ ਜਿਸ ਤਰ੍ਹਾਂ ਕਿ ਗੱਲ ਸਭ ਤੋਂ ਪਹਿਲਾਂ ਗੱਲ ਕਰੀਏ ਤਾਂ ਮੁਸਲਮਾਨ ਮੁਸਲਮਾਨ ਈਦ ਮਨਾਉਂਦੇ ਨੇ ਰੋਜ ਈਦ ਵਾਲੇ ਦਿਨ ਰੋਜ਼ਾ ਰੱਖਦੇ ਨੇ ਰੋਜ਼ੇ ਵਾਲੇ ਦਿਨ ਉਹ ਸਿਰਫ ਰੋਟੀ ਨਹੀਂ ਖਾਂਦੇ ਸਿਰਫ ਫਰੂਟ ਹੀ ਖਾਂਦੇ ਨੇ ਇਸ ਤੋਂ ਇਲਾਵਾ ਉਹ ਦਰਗਾਹ 'ਤੇ ਜਾ ਕੇ ਮੱਥੇ ਟੇਕਦੇ ਨੇ ਸਾਰੇ ਹੀ ਧਰਮ ਵਧੀਆ ਨੇ ਕਿਸੇ ਵੀ ਧਰਮ ਬਾਰੇ ਮੈਂ ਕੁਛ ਵੀ ਮਾੜਾ ਚੰਗਾ ਨਹੀਂ ਬੋਲਣਾ ਚਾਹੁੰਦੀ ਇਸ ਤੋਂ ਇਲਾਵਾ ਦੂਜ ੲਸ ਦੂਜੇ ਨੰਬਰ 'ਤੇ ਗੱਲ ਕਰੀਏ ਤਾਂ ਹਿੰਦੂ ਧਰਮ ਹਿੰਦੂ ਧਰਮ ਵਾਲੇ ਵੀ ਅਪ ਮੰਦਰ ਵਿੱਚ ਜਾਂਦੇ ਨੇ ਪੂਜਾ ਕਰਦੇ ਨੇ ਸ਼ਨੀਵਾਰ ਦਾ ਜਿਸ ਤਰ੍ਹਾਂ ਸ਼ਨੀਵਾਰ ਦਾ ਵਰਤ ਰੱਖਦੇ ਨੇ ਸੋਮਵਾਰ ਦਾ ਵਰਤ ਰੱਖਦੇ ਨੇ ਉਹ ਸਾਰਿਆਂ ਨੂੰ ਆਪੋ ਆਪਣੇ ਧਰਮ ਪਿਆਰੇ ਹੁੰਦੇ ਨੇ ਸਿੱਖ ਧਰਮ ਸਿੱਖ ਧਰਮ ਵਿੱਚ ਲੋਕ ਸਿੱਖ ਧਰਮ ਵਾਲੇ ਗੁਰੂ ਘਰ ਵਿੱਚ ਜਾਂਦੇ ਨੇ ਗੁਰੂ ਘਰ ਵਿੱਚ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਨੇ ਗੁਰੂ ਸਾਰੇ ਧਰਮਾਂ ਨੂੰ ਹਾਜ਼ਰ ਨਾਜ਼ਰ ਮੰਨ ਕੇ ਉੱਥੇ ਹੀ ਰਾਤ ਪਾਠ ਪਾਠ ਕੀਤੇ ਜਾਂਦੇ ਨੇ ਸਾਰੇ ਧਰਮਾਂ ਨੂੰ ਇੱਕੋ ਬਰਾਬਰ ਹੀ ਮੰਨਿਆ ਜਾਂਦਾ ਹੈ ਸਿੱਖ ਧਰਮ ਵਾਲੇ ਲੋਕ ਜਿੱਦਾਂ ਕਿ ਗੁਰਪੁਰਬ ਦੀਵਾਲੀ ਵਿਸਾਖੀ ਦੁਸਹਿਰਾ ਦੀਵਾਲੀ ਵਿਸਾਖੀ ਨੂੰ ਹੀ ਵਿਸਾਖੀ ਗੁਰਪੁਰਬ ਸਾਰੇ ਧਰਮ ਹੁਣ ਮੰਨਦੇ ਨੇ ਇਸ ਲਈ ਸਾਨੂੰ ਸਾਰੇ ਧਰਮਾਂ ਨੂੰ ਇੱਕੋ ਬਰਾਬਰ ਰੱਖਣਾ ਚਾਹੀਦਾ ਕੋਈ ਵੀ ਧਰਮ ਮਾੜਾ ਨਹੀਂ ਹੈ ਸਾਰਿਆਂ ਨੂੰ ਆਪੋ ਆਪਣੇ ਧਰਮ ਹੀ ਵਧੀਆ ਲੱਗਦਾ ਹੈ ਸਾਨੂੰ ਸਾਰੇ ਧਰਮਾਂ ਨੂੰ ਬਰਾਬਰ ਸਤਿਕਾਰ ਦੇਣਾ ਚਾਹੀਦਾ ਹੈ